ਸਤਿ ਸ਼੍ਰੀ ਅਕਾਲ ਜੀ ਮੇਰੀ ਗੱਲ ਸੁਖਵਿੰਦਰ ਸਿੰਘ ਨਾਲ ਹੋ ਰਹੀ ਆ ਹਾਂਜੀ ਭਾਅ ਜੀ ਤੁਸੀਂ ਸਾਨੂੰ ਰਾਤੀ ਬਚਾਇਆ ਤੁਸੀਂ ਰਾਤੀ ਨਾ ਨਾ ਆਉਂਦੇ ਤਾਂ ਪਤਾ ਨਹੀਂ ਸਾਡਾ ਕੀ ਬਣਨਾ ਸੀ ਵੈਸੇ ਤਾਂ ਇਹੋ ਜਿਹੇ ਵੀਰ ਵੀ ਦੁਨੀਆਂ 'ਤੇ ਕਿਤੇ ਕਿਤੇ ਹੀ ਮਿਲਦੇ ਆ ਕਿਉਂਕਿ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਬਣਦਾ ਕਿਉਂਕੀ ਕੋਈ ਕਿਸੇ ਨੂੰ ਭੈਣ ਨਹੀਂ ਸਮਝਦਾ ਠੀਕ ਹੈ ਤੁਸੀਂ ਸਾਨੂੰ ਬਚਾਇਆ ਤੁਸੀਂ ਬਹੁਤ ਵਧੀਆ ਕੀਤਾ ਬਾਕੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਤੁਹਾਡੇ ਪੈਸੇ ਵੀ ਦੇਣਾ ਚਾਹੁੰਦੀ ਤੁਸੀਂ ਸਾਨੂੰ ਉਧਾਰ ਛੱਡ ਗਏ ਅੱਧੀ ਰਾਤੀ ਆਏ ਉਦੋਂ ਬਾਅਦ ਸਾਨੂੰ ਪਤਾ ਨਹੀਂ ਤੁਸੀਂ ਚਲੇ ਗਏ ਅਤੇ ਹੁਣ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੁਸੀਂ ਇੱਕ ਵਾਰੀ ਆ ਕੇ ਮਿਲੋ ਨਾਲੇ ਆਪਣੇ ਪੈਸੇ ਲੈ ਜਾਓ ਅਤੇ ਨਾਲੇ ਕਿਉਂਕਿ ਦੁਨੀਆਂ ਦੇ ਇਹੋ ਜਿਹਾ ਬੰਦਾ ਕਿਤੇ ਨਹੀਂ ਮਿਲਦਾ ਚੰਗਾ ਮ ਬੁਰਾਈਆਂ ਕਰਨ ਨੂੰ ਵਾਧੂ ਬੈਠੇ ਹੋਏ ਆ ਠੀਕ ਆ ਭੈਣ ਨੂੰ ਬਚਾਉਣਾ ਬਹੁਤ ਵੱਡੀ ਇੱਜ਼ਤ ਹੁੰਦੀ ਭਰਾ ਦੀ ਭਰਾ ਅਤੇ ਫਿਰ ਵੀ ਭੈਣਾਂ ਦੇ ਕੰਮ ਆਉਂਦੇ ਆ ਕਦੇ ਨਾ ਕਦੇ ਆਂ ਆਉਂਦੇ ਵੀ ਆ ਅਤੇ ਆਉਣੇ ਵੀ ਚਾਹੀਦੇ ਆ ਇਸ ਵਾਸਤੇ ਅਤੇ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਧਿਆਨ ਰੱਖੋ ਬਾਕੀ ਜਿਹੜਾ ਆਪਣਾ ਪੈਸੇ ਪੂਸੇ ਆ ਦੱਸ ਦਓ ਤੁਸੀਂ ਆਪਣਾ ਐਡਰੈਸ ਮੈਂ ਤੁਹਾਡੇ ਘਰ ਪਹੁੰਚਾ ਦੂੰਗੀ ਮੇਰਾ ਬੇਟਾ ਆਏਗਾ ਅਤੇ ਮੈਂ ਉਹਦੇ ਨਾਲ ਵੀ ਗੱਲ ਕੀਤੀ ਸੀ ਉਹ ਵੀ ਕਹਿਣ ਲੱਗੇ ਨਹੀਂ ਭਾਅ ਜੀ ਬਹੁਤ ਚੰਗੇ ਆ ਤੁਸੀਂ ਉਹਨਾਂ ਦੇ ਪੈਸੇ ਪਹੁੰਚਾਓ ਜਿੱਦਾਂ ਵੀ ਹੁੰਦਾ ਜੇਕਰ ਤੁਸੀਂ ਨਾ ਆਉਂਦੇ ਅਤੇ ਚਲੋ ਫਿਰ ਵੀ ਇਹੋ ਜਿਹਾ ਕੰਮ ਨੇਕ ਬੰਦੇ ਹੀ ਕਰਦੇ ਆ ਠੀਕ ਆ ਕਰਦੇ ਆ ਨਾ ਧੰਨਵਾਦ ਜੀ